ਮੋਹਾਲੀ ਜ਼ਿਲ੍ਹੇ ਵਿੱਚ ਘੁੰਮਣ ਯੋਗ ਥਾਵਾਂ ਬਾਬਾ ਬੰਦਾ ਸਿੰਘ ਬਹਾਦਰ ਵਾਰ ਮੈਮੋਰੀਅਲ ਗੁਰਦੁਆਰਾ ਅੰਬ ਸਾਹਿਬ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਬਿੰਦਰਾ ਸਟੇਡੀਅਮ ਫਤਿਹ ਬੁਰਜ ਅਤੇ ਵੀ ਆਰ ਪੰਜਾਬ ਹੈ ਜਿਸ ਵਿੱਚ ਲੋਕ ਫਿਲਮਾਂ ਵਗੈਰਾ ਦੇਖਣ ਆਉਂਦੇ ਹਨ